ਕੰਮ ਤੋਂ ਬਾਹਰ ਮੇਰੇ ਬਹੁਤ ਸਾਰੇ ਸ਼ੌਂਕ ਹਨ ਮੈਨੂੰ ਕੰਮ ਤੋਂ ਬਾਅਦ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਹੈ ਮੈਨੂੰ ਖਾਣਾ ਬਣਾਉਣਾ ਬਹੁਤ ਪਸੰਦ ਹੈ ਇਸ ਤੋਂ ਇਲਾਵਾ ਮੈਨੂੰ ਨੱਚਣਾ ਗਾਉਣਾ ਅਤੇ ਬਾਹਰ ਘੁੰਮਣਾ ਫਿਰਨਾ ਬਹੁਤ ਹੀ ਪਸੰਦ ਹੈ ਜਦ ਮੈਨੂੰ ਟਾਈਮ ਲੱਗਦਾ ਹੈ ਤਾਂ ਮੈਂ ਬਾਹਰ ਜਾ ਕੇ ਘੁੰਮਦੀ ਹਾਂ ਅਤੇ ਬਾਹਰ ਸ਼ੋਪਿੰਗ ਕਰਨ ਜਾਂਦੀ ਹਾਂ